ਹਾਂਜੀ ਨਮਸਕਾਰ ਜੀ ਸਰ ਸਰ ਐਨ ਜੀ ਕੇ ਟਰੈਵਲ ਤੋਂ ਗੱਲ ਕਰ ਰਹੇ ਹੋ ਮੈਂ ਪਹਿਲਾਂ ਵੀ ਕਈ ਵਾਰ ਤੁਹਾਡੀ ਜਿਹੜੀ ਕੈਬ ਆ ਬੁੱਕ ਕਰਵਾਈ ਹੈਗੀ ਆ ਚੰਡੀਗੜ੍ਹ ਜਾਣ ਵਾਸਤੇ ਮੈਂ ਚੰਡੀਗੜ੍ਹ ਜਾਣਾ ਸੀ ਤਾਂ ਮਤਲਬ ਅੱਗੇ ਮੈਂ ਤੁਹਾਡੀ ਜਿਹੜੀ ਸਰਵਿਸ ਆ ਉਹ ਬਹੁਤ ਅੱਛੀ ਹੈ ਅਤੇ ਮੈਂ ਕਾਫ਼ੀ ਵਾਰ ਤੁਹਾਡੇ ਨਾਲ ਗਿਆ ਹੈਗਾ ਅਤੇ ਇਸ ਵਾਰ ਇੱਕ ਦਿੱਕਤ ਆ ਰਹੀ ਮੈਨੂੰ ਕਿ ਤੁਸ ਤੁਹਾਨੂੰ ਮੈਂ ਪਹਿਲਾਂ ਮਤਲਬ ਔਨਲਾਈਨ ਪੇਮੈਂਟ ਕਰਦਾ ਅਤੇ ਇਸ ਵਾਲ ਇਸ ਵਾਰ ਮੇਰੀ ਦਿੱਕਤ ਇਹ ਸੀਗੀ ਵੀ ਮੇਰੇ ਕੋਲ ਜਿਹੜੀ ਹੈ ਔਨਲਾਈਨ ਪੇਮੈਂਟ ਨਹੀਂ ਹੈਗੀ ਕੈਸ਼ ਹੈਗਾ ਨਗਦ ਹੈਗਾ ਤਾਂ ਕਿ ਮੈਂ ਤੁਹਾਨੂੰ ਨਗਦ ਰਾਹੀਂ ਇਹ ਭੁਗਤਾਨ ਕਰ ਸਕਦਾ ਹੈਗਾ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਆਵੇਗੀ ਜਾਂ ਤੁਹਾਡੇ ਰੂਲ ਐਂਡ ਰੈਗੂਲੇਸ਼ਨ ਦੇ ਇਹ ਕੋਈ ਖਿਲਾਫ ਤਾਂ ਨਹੀਂ ਕਿ ਤੁਸੀਂ ਔਨਲਾਈਨ ਹੀ ਪੇਮੈਂਟ ਲੈਣੀ ਹੈ ਕਿਉਂਕਿ ਐਟ ਏ ਟਾਈਮ ਮੇਰੇ ਕੋਲ ਔਨਲਾਈਨ ਪੇਮੈਂਟ ਨਹੀਂ ਹੈ ਅਤੇ ਮੇਰਾ ਜਾਣਾ ਵੀ ਬਹੁਤ ਜ਼ਰੂਰੀ ਹੈਗਾ ਅਤੇ ਐਮਰਜੈਂਸੀ ਦੇ ਵਿੱਚ ਮੈਨੂੰ ਜਾਣਾ ਪੈ ਰਿਹਾ ਤਾਂ ਮੇਰੇ ਕੋਲ ਇਹ ਸਮੱਸਿਆ ਹੈ ਇਸ ਵਾਰ ਮਤਲਬ ਮੈਂ ਕੈਸ਼ ਹੀ ਦੇ ਪਾਊਂਗਾ ਅਤੇ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਆਵੇਗੀ ਇਸ ਗੱਲ ਦੀ ਕਿ ਤੁਸੀਂ ਮੈਨੂੰ ਇਹ ਕਨਫਰਮ ਕਰ ਸਕਦੇ ਹੋ ਤਾਂ ਇਸ ਤਰੀਕੇ ਦੇ ਨਾਲ ਆਪਾਂ ਮੈਂ ਇਹਨੂੰ ਮਤਲਬ ਮੈਂ ਜਾ ਸਕਦਾ ਜਾਂ ਮੈਂ ਕੋਈ ਹੋਰ ਤਰ੍ਹਾਂ ਦਾ ਅਰੇਂਜ ਕਰਾਂ ਇਹ ਮੈਨੂੰ ਤੁਸੀਂ ਜ਼ਰੂਰ ਕਲੀਅਰ ਕਰਕੇ ਦੱਸੋ ਧੰਨਵਾਦ